ਜਿਹੜੀ ਪੰਜਾਬੀ ਭਾਸ਼ਾ ਉਹ ਪੰਜਾਬ 'ਚ ਬੋਲੀ ਜਾਂਦੀ ਆ ਅਤੇ ਹੁਣ ਦੇ ਸਮੇਂ 'ਚ ਜਿਉਂ ਪੰਜਾਬੀ ਬਾਹਰ ਜਾ ਰਹੇ ਨੇ ਅਤੇ ਪੰਜਾਬ ਤੋਂ ਬਾਹਰ ਵੀ ਇਸ ਦਾ ਰੁਝਾਨ ਵੱਧਦਾ ਜਾ ਰਿਹਾ ਹਿੰਦੀ ਭਾਸ਼ਾ ਉਹ ਸਾਰੇ ਭਾਰਤ 'ਚ ਹੀ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਲਈ ਜਿਹੜੀ ਪੰਜਾਬ 'ਚ ਢੁਕਵੀਂ ਲਿਪੀ ਆ ਉਹ ਗੁਰਮੁਖੀ ਲਿਪੀ ਆ ਅਤੇ ਲਹਿੰਦੇ ਪੰਜਾਬ 'ਚ ਜਿਹੜੀ ਢੁਕਵੀਂ ਲ ਬੋਲੀ ਜਾਂਦੀ ਆ ਉਹ ਹੈਗੀ ਹੈ ਸ਼ਾਹਮੁਖੀ ਅਤੇ ਹਿੰਦੀ ਭਾਸ਼ਾ ਲਈ ਦੇਵਨਾਗਰੀ ਲਿਪੀ ਢੁੱਕਵੀਂ ਆ ਦੋਹਾਂ ਦਾ ਵਿਆਕਰਨ ਵੱਖੋ ਵੱਖਰਾ ਅਤੇ ਦੋਹਾਂ ਜਿਹੜੀਆਂ ਭਾਸ਼ਾਵਾਂ ਨੇ ਇੰਡੋ ਆਰੀਅਨ ਭਾਸ਼ਾਵਾਂ ਨੇ ਇਹ ਅਤੇ ਪੰਜਾਬੀ ਭਾਸ਼ਾ ਦੇ ਪਹਿਲਾਂ ਪੈਂਤੀ ਅੱਖਰ ਸਨ ਉਸ ਤੋਂ ਬਾਅਦ ਫਾਰਸੀ ਅੱਖਰਾਂ ਨੂੰ ਐਡ ਕਰਨ 'ਤੇ ਇੱਕਤਾਲੀ ਹੋ ਗਏ ਅਤੇ ਹਿੰਦੀ ਭਾਸ਼ਾ ਦੇ ਬਵੰਜਾ ਅੱਖਰ ਨੇ ਟੋਟਲ